ਹੈਲੋ ਹਾਂਜੀ ਵੀਰ ਜੀ ਇਹਦਾ ਐਂ ਜੀ ਤੁਸੀਂ ਬੁਲਾਇਆ ਸੀ ਨਾ ਕੋਈ ਕੰਮ ਸੀਗਾ ਸੋਲਰ ਦਾ ਅੱਛਾ ਨਹੀਂ ਤੁਸੀਂ ਦੱਸਿਆ ਸੀ ਨਾ ਕੋਈ ਫੈਕਟਰੀ 'ਤੇ ਲਵਾਉਣਾ ਹੈ ਫੈਕਟਰੀ ਹੈ ਤੁਹਾਡੀ ਅਪ ਉਹ 'ਤੇ ਲਵਾਉਣਾ ਹੈ ਹਾਂ ਹਾਂ ਲ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਇਹ ਤਾਂ ਦੇਖੋ ਬੜਾ ਵਧੀਆ ਪ੍ਰੋਜੈਕਟ ਹੈ ਇਹਦੇ 'ਚ ਕੀ ਹੈ ਤੁਹਾਡਾ ਇੱਕ ਵਾਰ ਖ਼ਰਚਾ ਆਉਣਾ ਹੈਗਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਬਿੱਲ ਹੈ ਬਿਜਲੀ ਦਾ ਉਹ ਨਹੀਂ ਆਊਗਾ ਜਿਹੜਾ ਸੂਰਜ ਦੀ ਊਰਜਾ ਨਾਲ ਜਿਹੜੀ ਬਿਜਲੀ ਬਣੂਗੀ ਉਹੀ ਤੁਸੀਂ ਵਰਤੋਂਗੇ ਅਤੇ ਜਾਂ ਤੁਸੀਂ ਬਿਜਲੀ ਜੇ ਵੱਧ ਬਣ ਜਾਵੇ ਤਾਂ ਉਹਨੂੰ ਸਰਕਾਰ ਨੂੰ ਵੇਚ ਵੀ ਸਕਦੇ ਹੋ ਅਤੇ ਸਰਕਾਰ ਉਹਨੂੰ ਵਾਪਸ 'ਚ ਲੈ ਲੂਗੀ ਤੁਹਾਡੇ ਤੋਂ ਉਹਦੇ ਬਦਲੇ ਪੈਸੇ ਮਿਲਣਗੇ ਜਾਂ ਜਿਹੜਾ ਤੁਹਾਡਾ ਬਿੱਲ ਆਉਂਦਾ ਉਹ ਘੱਟ ਜੂਗਾ ਨਹੀਂ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਇਹ ਹੈ ਵੀ ਜੋ ਸੂਰਜ ਤੋਂ ਊਰਜਾ ਆਈ ਉਹ ਦੇ ਨਾਲ ਕੀ ਹੈ ਵੀ ਇਹਨੇ ਬਿਜਲੀ ਬਣਾ ਦੇਣੀ ਹੈ ਉਸ ਬਿਜਲੀ ਨੂੰ ਤੁਸੀਂ ਬੈਟਰੀ ਰੱਖ ਕੇ ਸਟੋਰ ਵੀ ਕਰ ਸਕਦੇ ਹੋ ਉਸ ਬਿਜਲੀ ਨੂੰ ਤੁਸੀਂ ਬੈਟਰੀ ਨਹੀਂ ਰੱਖਣੀ ਬੈਟਰੀ ਦਾ ਖ਼ਰਚਾ ਬਚਾਉਣਾ ਹੈ ਤਾਂ ਕੀ ਕਰੋ ਵੀ ਸਿੱਧਾ ਖੰਬੇ 'ਤੇ ਜੋੜ ਦਿੰਦੇ ਹਾਂ ਅਸੀਂ ਸਰਕਾਰ ਦੀ ਬਿਜਲੀ ਨਾਲ ਤਾਂ ਉਹਦੇ ਨਾਲ ਕੀ ਹੋਵੇਗਾ ਮੰਨ ਲਓ ਤੁਹਾਡੇ ਸੋਲਰ ਸਿਸਟਮ ਨੇ ਦਸ ਯੂਨਿਟ ਬਿਜਲੀ ਇੱਕ ਦਿਨ ਦੀ ਬਣਾ 'ਤੀ ਤਾਂ ਦਸ ਯੂਨਿਟ ਉਹ ਸਿੱਧੇ ਖੰਬੇ ਤੋਂ ਬਿਜਲੀ ਬੋਰਡ ਨੂੰ ਚਲੇ ਜਾਣਗੇ ਅਤੇ ਦਸ ਯੂਨਿਟ ਦਾ ਤੁਹਾਡੇ ਖਾਤੇ 'ਚ ਪਲੱਸ ਹੋ ਜਾਣਗੇ ਤੁਸੀਂ ਮੰਨ ਲਓ ਰਾਤ ਨੂੰ ਕੀ ਕੀਤਾ ਦਸ ਯੂਨਿਟ ਯੂਜ਼ ਕਰ ਲਏ ਆਪਣੇ ਘਰ ਦੇ ਕੁਝ ਚੀਜ਼ਾਂ ਚਲਾਉਣ ਵਾਸਤੇ ਤਾਂ ਤੁਹਾਡਾ ਬਿੱਲ ਜਿਹੜਾ ਜੀਰੋ ਹੋ ਗਿਆ ਵੀ ਜਿਹੜਾ ਦਸ ਯੂਨਿਟ ਦਿਨੇ ਬਣਾ ਕੇ ਤੁਸੀਂ ਸਰਕਾਰ ਨੂੰ ਦਿੱਤੇ ਰਾਤ ਨੂੰ ਤੁਸੀਂ ਆਪਣੀ ਫੈਕਟਰੀ ਦੀ ਮਸ਼ੀਨਾਂ ਚਲਾ ਲਈਆਂ ਜਾਂ ਦਿਨੇ ਚਲਾ ਲਈਆਂ ਚਾਹੇ ਵੀ ਜਿੰਨੀ ਤੁਸੀਂ ਬਿਜਲੀ ਵਰਤੀ ਗਏ ਮੰਨ ਲਓ ਤੁਸੀਂ ਪੰਦਰਾਂ ਯੂਨਿਟ ਵਰਤਦੇ ਹੋ ਤੁਹਾਡਾ ਸੋਲਰ ਦਸ ਬਣਾ ਰਿਹਾ ਹੈ ਤਾਂ ਪੰਜ ਯੂਨਿਟ ਜਿਹੜੇ ਹੈਗੇ ਉਹਦਾ ਹੀ ਬਿੱਲ ਆਵੇਗਾ ਤੁਹਾਨੂੰ ਹਾਂ ਸਰਕਾਰ ਦਿੰਦੀ ਹੈ ਜੀ ਸਰਕਾਰ ਦਿੰਦੀ ਹੈ ਜਿਵੇਂ ਫੈਕਟਰੀਆਂ 'ਤੇ ਜੇ ਬਹੁਤ ਵੱਡਾ ਤੁਸੀਂ ਲਾਉਣਾ ਹੈ ਫਿਰ ਤਾਂ ਨਹੀਂ ਮਿਲਣੀ ਜੇ ਤੁਸੀਂ ਦਸ ਕਿਲੋਵਾਟ ਤੱਕ ਦਾ ਲਾਉਂਦੇ ਹੋ ਤਾਂ ਤੁਹਾਨੂੰ ਸਬਸਿਟੀ ਮਿਲੂਗੀ ਉਹਦੇ 'ਚੋਂ ਤੀਹ ਚਾਲੀ ਪਰਸੈਂਟ ਤੁਹਾਡਾ ਖ਼ਰਚਾ ਜਿਹੜਾ ਹੈਗਾ ਉਹ ਘੱਟ ਹੋ ਜੂਗਾ ਜਿੰਨਾ ਵੀ ਖ਼ਰਚਾ ਆਏਗਾ ਅਤੇ ਤੁਹਾਡੀ ਛੱਤ ਦੱਸਿਓ ਕਿੰਨੀ ਕੁ ਹੈ ਸਾਈਜ਼ ਦੱਸਿਓ ਕਿੰਨਾ ਛੱਤ ਦਾ ਤੁਹਾਡਾ ਕਿੰਨੇ ਬਾਈ ਕਿੰਨੇ ਫੁੱਟ ਹੋਊ ਚਾਲੀ ਬਾਈ ਪੱਚੀ ਦੀ ਚਾਲੀ ਬਾਈ ਪੱਚੀ ਅਤੇ ਤੁਹਾਡਾ ਫਿਰ ਪੰਜ ਕਿਲੋਵਾਟ ਦਾ ਅਸੀਂ ਲਾ ਸਕਦੇ ਹੈ ਪੰਜ ਕਿਲੋਵਾਟ ਦਾ ਸੋਲਰ ਪੈਨਲ ਲੱਗ ਜੂਗਾ ਪੰਜ ਕਿਲੋਵਾਟ ਦਾ ਸਮਝ ਲਓ ਵੀ ਤੁਹਾਡੇ ਵੀਹ ਪੱਚੀ ਯੂਨਿਟ ਰੋਜ਼ ਦੇ ਬਣਾ ਦੂਗਾ ਜੇ ਵੀਹ ਪੱਚੀ ਜੇ ਅੱਠ ਰੁਪਏ ਯੂਨਿਟ ਵੀ ਲਾਓ ਤਾਂ ਸਮਝ ਲਓ ਦੋ ਸੌ ਰੁਪਏ ਦੀ ਬਿਜਲੀ ਤੁਹਾਡੀ ਰੋਜ਼ ਬਣ ਜੂਗੀ ਉਹਦੇ ਤੋਂ ਫ੍ਰੀ 'ਚ ਉਹ ਹਾਂ ਉਹ ਤਾਂ ਦੇਖੋ ਜੀ ਜਾਂ ਤਾਂ ਕਦੇ ਕਦਾਈਂ ਬਰਸਾਤ ਹੁੰਦੀ ਹੈ ਓਦੋਂ ਸਾਫ਼ ਹੋ ਜਾਂਦੀ ਹੈ ਧੂੜ ਮਿੱਟੀ ਨਾਲ ਐਫੀਸ਼ੈਂਸੀ ਤਾਂ ਘੱਟਦੀ ਹੈ ਜੇ ਤੁਸੀਂ ਆਪ ਕਦੇ ਕਦਾਈਂ ਜਾਂ ਤੁਹਾਡੀ ਫੈਕਟਰੀ ਦਾ ਕੋਈ ਵਰਕਰ ਨੂੰ ਕਹਿ ਦਿਓ ਵੀ ਥੋੜ੍ਹੀ ਸਾਫ਼ ਸਫ਼ਾਈ ਕਰਿਆ ਤਾਂ ਥੋੜ੍ਹੀ ਐਫੀਸ਼ੈਂਸੀ ਵੱਧ ਜੂਗੀ ਜੇ ਵੀਹ ਯੂਨਿਟ ਬਣਾਉਂਦਾ ਜੇ ਮਿੱਟੀ ਮੁੱਟੀ ਤਾਂ ਅਠਾਰਾਂ ਬਣਾ ਦੂਗਾ ਜੇ ਸਾਫ਼ ਕਰ 'ਤਾ ਦੋ ਯੂਨਿਟ ਵੱਧ ਬਣਾ ਦੂਗਾ ਨਹੀਂ ਤਾਂ ਬਰਸਾਤ ਪੈਂਦੀ ਹੈ ਉਹ ਸਾਫ਼ ਹੋ ਜਾਂਦਾ ਹੂੰ ਹੂੰ ਹਾਂ ਘੱਟ ਅਸੀਂ ਕੱਟ ਕੇ ਨਾ ਨਾ ਤੁਸੀਂ ਤੁਸ ਨਾ ਨਾ ਤੁਸੀਂ ਕੱਟ ਕੇ ਦੇਣੇ ਨੇ ਸਾਨੂੰ ਬਾਅਦ 'ਚ ਨਹੀਂ ਆਉਂਦੇ ਤੁਸੀਂ ਕੱਟ ਕੇ ਦੇ ਦਿਓ ਅਸੀਂ ਆਪੇ ਸਰਕਾਰ ਤੋਂ ਲਵਾਂਗੇ ਤੁਹਾਡੀ ਉਹ 'ਚ ਕੋਈ ਸਿਰਦਰਦੀ ਨਹੀਂ ਹੈ ਠੀਕ ਹੈ ਨਾ ਜੀ ਹੂੰ ਹੂੰ ਨਾ ਨਾ ਨਾ ਬਿਲਕੁਲ ਨਹੀਂ ਅਸੀਂ ਬੜੇ ਲਾਏ ਨੇ ਇੱਦਾਂ ਦੀ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਇੱਦਾਂ ਕਰਾਂਗੇ ਤੁਸੀਂ ਮੇਰੇ ਨਾਲ ਚੱਲਿਓ ਜਿਹੜੇ ਇੱਕ ਦੋ ਫੈਕਟਰੀਆਂ ਅਸੀਂ ਲਾਏ ਹੈ ਪਹਿਲਾਂ ਤੁਹਾਨੂੰ ਪਹਿਲਾਂ ਦਿਖਾ ਕੇ ਲਿਆਵਾਂਗੇ ਉਨ੍ਹਾਂ ਦੇ ਮਾਲਕ ਨਾਲ ਗੱਲ ਕਰਾ ਦਾਂਗੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਲਗਵਾ ਲਿਓ ਠੀਕ ਹੈ ਨਾ ਨਾ ਨਾ ਨਾ ਉਹ ਬੰਦ ਹੋਵੇਗੀ ਅਤੇ ਨਾ ਨਾ ਨਾ ਏ ਟੂ ਜ਼ੈਡ ਤਾਰ ਤੂਰ ਦਾ ਸਾਰਾ ਖ਼ਰਚਾ ਸਾਡਾ ਹੋਵੇਗਾ ਉਹ ਅਸੀਂ ਕਰ ਕੇ ਦੇਵਾਂਗੇ ਅਤੇ ਸਾਰਾ ਕੁਛ ਬਿਲਕੁਲ ਸੇਫ ਹੋਵੇਗਾ ਹਾਂ ਤੁਸੀਂ ਮੇਰੇ ਨਾਲ ਆਇਓ ਬਾ ਠੀਕ ਠੀਕ ਹੈ ਜੀ ਠੀਕ ਹੈ ਓਕੇ ਜੀ ਥੈਂਕਿਊ